ਸਤਿ ਸ੍ਰੀ ਅਕਾਲ ਮੇਰਾ ਨਾਂ ਸ਼ਵਨ ਪ੍ਰਸ਼ਾਦ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕੱਲ੍ਹ ਮੈਂ ਅ ਅਮਨ ਟਰੈਵਲ ਤੋਂ ਕੈਬ ਬੁੱਕ ਕਰਵਾਈ ਸੀ ਮੈਨੂੰ ਪ੍ਰੇਮ ਨਗਰ ਤੋਂ ਚੰਡੀਗੜ੍ਹ ਜਾਣਾ ਸੀ ਮੈਂ ਤੁਹਾਨੂੰ ਸਵੇਰੇ ਅੱਠ ਵਜੇ ਦਾ ਟਾਈਮ ਦਿੱਤਾ ਸੀ ਪਰ ਕਿਸੇ ਕਾਰਨ ਮੈਂ ਰਾਤ ਨੂੰ ਰੋਪੜ ਚਲੀ ਗਈ ਹੁਣ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਸਵੇਰੇ ਸਾਢੇ ਸੱਤ ਵਜੇ ਗਿਆਨੀ ਜੈਲ ਸਿੰਘ ਤੋ ਪਿਕ ਕਰ ਲਓ ਜੇ ਤੁਹਾਨੂੰ ਮੇਰੀ ਲੋਕੇਸ਼ਨ ਜਾਂ ਐਡਰੈਸ ਦਾ ਪਤਾ ਨਹੀਂ ਲੱਗਦਾ ਹੈ ਤਾਂ ਤੁਸੀਂ ਮੈਨੂੰ ਕੋਲ ਕਰ ਲਿਓ ਅਤੇ ਸਾਡੇ ਸਾਡਾ ਸਵੇਰੇ ਚੰਡੀਗੜ੍ਹ ਜਾਣਾ ਬਹੁਤ ਜ਼ਰੂਰੀ ਹੈ ਮੇਰੇ ਨਾਲ ਮੇਰੀ ਫੈਮਿਲੀ ਵੀ ਹੈ ਸਾਡਾ ਚੰਡੀਗੜ੍ਹ ਪਹੁੰਚਣਾ ਬਹੁਤ ਜ਼ਰੂਰੀ ਹੈ ਮੈਨੂੰ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਸਵੇਰੇ ਟਾਈਮ 'ਚ ਇਹਦੇ ਉੱਥੇ ਪਹੁੰਚ ਜਿਓ ਮੈਨੂੰ ਤੁਹਾਡੀ ਬਹੁਤ ਧੰਨਵਾਦੀ ਹੋਵਾਂਗੀ